ਗੁਰਦਾਸਪੁਰ ਜ਼ਿਲ੍ਹੇ ਵਿੱਚ ਬਹੁਤ ਜ਼ਿਆਦਾ ਤਿਉਹਾਰ ਮਨਾਏ ਜਾਂਦੇ ਹੈ ਜਿੱਦਾਂ ਦੁਸਹਿਰਾ ਬੁੱਧਾਪੁਰਨੀਮਾ ਅਤੇ ਹੋਲੀ ਅਤੇ ਇਸ ਵਿੱਚੋਂ ਮੈਂ ਤੁਹਾਨੂੰ ਹੋਲੀ ਦੱਸਦਾ ਹਾਂ ਕਿ ਸਾਡੇ ਇੱਥੇ ਹੋਲੀ ਕਿੱਦਾਂ ਮਨਾਈ ਜਾਂਦੀ ਹੈ ਸਾਡੇ ਇੱਧਰ ਹੋਲੀ ਬਹੁਤ ਹੀ ਚੰਗੇ ਤਰੀਕੇ ਨਾਲ ਮਨਾਈ ਜਾਂਦੀ ਹੈ ਸਾਰੇ ਲੋਕ ਇੱਕ ਦੂਜੇ ਨਾਲ ਹੋਲੀ ਮਨਾਉਂਦੇ ਹੈ ਕੋਈ ਵੀ ਇੱਕ ਦੂਜੇ ਨਾਲ ਨਰਾਜ ਨਹੀਂ ਹੁੰਦਾ ਹੈ ਸਾਰੇ ਲੋਕ ਜ਼ਿਆਦਾ ਤੋਂ ਜ਼ਿਆਦਾ ਰੰਗ ਇੱਕ ਦੂਜੇ ਨੂੰ ਲਾਉਂਦੇ ਹਨ ਇੱਧਰ ਸਾਡੇ ਇੱਥੇ ਲੋਕ ਪਾਣੀ ਦੀ ਹੋਲੀ ਵੀ ਖੇਡਦੇ ਹੈ ਅਤੇ ਸੁੱਕੀ ਹੋਲੀ ਵੀ ਖੇਡਦੇ ਹੈ ਸਾਡੇ ਇੱਥੇ ਪਾਣੀ ਦੀ ਹੋਲੀ ਜ਼ਿਆਦਾ ਖੇਡੀ ਜਾਂਦੀ ਹੈ ਅਤੇ ਗਿੱਲੇ ਰੰਗ ਨਾਲ ਜ਼ਿਆਦਾ ਲੋਕ ਲਿਬੜਦੇ ਹਨ ਅਤੇ ਮੈਂ ਤੁਹਾਨੂੰ ਹੁਣ ਦੁਸਹਿਰੇ ਦੇ ਬਾਰੇ ਦੱਸਣਾ ਚਾਹੁੰਦਾ ਹਾਂ ਸਾਡੇ ਇੱਥੇ ਦੁਸਹਿਰੇ ਵੀਹ ਦਿਨ ਤੋਂ ਪਹਿਲਾਂ ਦੀਵਾਲੀ ਦੇ ਵੀਹ ਦਿਨ ਤੋਂ ਪਹਿਲਾਂ ਆਉਂਦਾ ਹੈ ਅਤੇ ਉਹ ਬਹੁਤ ਹੀ ਚੰਗੀ ਤਰ੍ਹਾਂ ਮਨਾਉਂਦੇ ਹਨ ਅਸੀਂ ਇੱਧਰ ਬਹੁਤ ਹੀ ਵੱਡਾ ਪੁਤਲਾ ਖੜ੍ਹਾ ਕਰਦੇ ਹਨ ਤਿੰਨੋਂ ਪਤਲੇ ਪੁਤਲੇ ਸਾਡੇ ਇੱਧਰ ਬਹੁਤ ਹੀ ਵੱਡੇ ਹੁੰਦੇ ਹਨ ਤਿੰਨੋਂ ਪੁਤਲੇ ਇੱਕ ਉਹਨ ਦੇ 'ਚੋਂ ਹੁੰਦਾ ਹੈ ਰਾਵਣ ਇੱਕ ਮੇਘਨਾਥ ਅਤੇ ਇੱਕ ਕੁੰਭਕਰਨ ਤਿੰਨੋਂ ਪੁਤਲਿਆਂ ਨੂੰ ਜਲਾ ਕੇ ਉਹਨਾਂ ਦੇ ਵਿੱਚ ਪਟਾਕੇ ਪਾਉਂਦੇ ਹਨ ਅਤੇ ਪਟਾਕਿਆਂ ਦੀ ਆਵਾਜ਼ਾਂ ਨਾਲ ਕਈ ਬੱਚੇ ਡਰ ਜਾਂਦੇ ਹੈ ਅਤੇ ਕਈ ਬੱਚੇ ਬਹੁਤ ਹੀ ਮਜੇ ਲੈਂਦੇ ਹਨ